ਇਸ ਦੌਰਾਨ ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਘਰ ਦਾ ਕਨੈਕਸ਼ਨ ਚੈੱਕ ਕਰਾਂਗਾ ਕਿ ਉਹ ਸਹੀ ਹੈ ਕਿ ਨਹੀਂ ਅਤੇ ਪਾਣੀ ਦੀ ਸਪਲਾਈ ਕਿੱਥੋਂ ਰੁਕੀ ਹੈ ਕਿਵੇਂ ਰੁਕੀ ਹੈ ਅਤੇ ਉਸ ਤੋਂ ਬਾਅਦ ਮੈਂ ਪਲੰਬਰ ਨੂੰ ਬੁਲਾਵਾਂਗਾ ਅਤੇ ਉਸ ਨੂੰ ਆਪਣੀ ਜਾਂਚ ਕਰਨ ਲਈ ਕਹਾਂਗਾ ਅਤੇ